ਹਾਂਜੀ ਸਾਡੇ ਖੇਤਰ ਦੇ ਵਿੱਚ ਔਰਤਾਂ ਦੀ ਭੂਮਿਕਾ ਅੱਗੇ ਨਾਲ ਬਹੁਤ ਬਦਲੀ ਆ ਪਹਿਲਾਂ ਜਿੱਥੇ ਔਰਤਾਂ ਸਿਰਫ ਘਰ ਦੇ ਕੰਮ ਕਰਦੀਆਂ ਸੀ ਅਤੇ ਕੁੜੀਆਂ ਦੀ ਪੜ੍ਹਾਈ ਦਾ ਕੋਈ ਵੀ ਖਾਸ ਪ੍ਰਬੰਧ ਨਹੀਂ ਸੀ ਖਾਸ ਕਰਕੇ ਪੇਂਡੂ ਇਲਾਕੇ ਵਿੱਚ ਪਰ ਹੁਣ ਪਿੰਡਾਂ ਦੀਆਂ ਕੁੜੀਆਂ ਬਹੁਤ ਪੜ੍ਹ ਲਿਖ ਗਈਆਂ ਨੇ ਬਹੁਤ ਵੱਡੇ ਵੱਡੇ ਅਹੁਦਿਆਂ 'ਤੇ ਕੰਮ ਕਰਦੀਆਂ ਨੇ ਕੋਈ ਅਧਿਆਪਕ ਲੱਗੀ ਹੋਈ ਹੈ ਕੋਈ ਮਿਨਿਸਟਰ ਲ ਲੱਗੀ ਹੋਈ ਹੈ ਕੋਈ ਡੀਸੀ ਲੱਗੀ ਹੋਈ ਹੈ ਕੋਈ ਵੀ ਔਰਤ ਆ ਜਾਂ ਕੁੜੀ ਆ ਕੋਈ ਨਾ ਕੋਈ ਮਹਿਕਮੇ 'ਚ ਇਸ ਟਾਈਮ ਕੰਮ ਕਰ ਰਹੀ ਹੈ

ਕੁੜੀਆਂ ਹੁਣ ਖੁਲ੍ਹ ਕੇ ਪੜ੍ਹਾਈ ਵੀ ਕਰ ਰਹੀਆਂ ਨੇ ਜਿਹੜੇ ਗਰੀਬ ਲੋਕ ਨੇ ਉਹ ਵੀ ਆਪਣੀਆਂ ਕੁੜੀਆਂ ਨੂੰ ਬਹੁਤ ਪੜ੍ਹਾ ਲ ਰਹੇ ਆ ਇਹ ਵੀ ਗੱਲ ਬਿਲਕੁਲ ਸਹੀ ਹੈ ਕਿ ਉਹ ਕੰਮ ਲਈ ਕਿਤੇ ਹੋਰ ਜਾਂਦੇ ਨੇ ਕਿਉਂਕਿ ਉਹਨਾਂ ਜਦੋਂ ਕੁੜੀਆਂ ਨੌਕਰੀ ਕਰਦੀ ਹਨ ਤਾਂ ਉਹਨਾਂ ਦੀ ਨੌਕਰੀ ਕਈ ਵਾਰ ਆਪਣੇ ਇਲਾਕੇ ਤੋਂ ਬਾਹਰ ਆਉਂਦੀ ਹੈ ਅਤੇ ਕੁੜੀਆਂ ਉੱਥੇ ਵੀ ਜਾਂਦੀਆਂ ਨੇ ਆਪਦਾ ਕੰਮ ਵੀ ਕਰਦੀਆਂ ਨੇ ਨਾਲ ਆਪਦੀ ਪੜ੍ਹਾਈ ਵੀ ਜਾਰੀ ਰੱਖਦੀਆਂ ਨੇ ਜਿਵੇਂ ਵੀ ਉਹ ਰਹਿੰਦੀਆਂ ਨੇ ਆਪਦੇ ਖਰਚੇ 'ਤੇ ਕੰਮ ਕਰ ਰਹੀਆਂ ਨੇ ਪਰ ਮੇਰੇ ਹਿਸਾਬ ਨਾਲ ਜਿਹੜੀ ਕੁੜੀਆਂ ਨੂੰ ਸਭ ਤੋਂ ਵੱਡੀ ਰੁਕਾਵਟ ਇਹੀ ਆ ਜਿਹੜਾ ਕਿ ਆਪਣੇ ਸਮਾਜ ਦੇ ਵਿੱਚ ਔਰਤਾਂ ਦੇ ਨਾਲ ਜੋ ਵੀ ਗਲਤ ਕੰਮ ਹੁੰਦੇ ਆ ਕੁੜੀਆਂ ਦੇ ਨਾਲ ਖਾਸ ਕਰਕੇ ਜਿਸ ਜਿਵੇਂ ਕਿ ਰੇਪ ਕੇਸ ਬਹੁਤ ਵੱਧ ਰਹੇ ਆ ਤਾਂ ਜਿਹੜੇ ਮਾਂ ਪਿਓ ਹੁੰਦੇ ਆ ਉਹਨਾਂ ਨੂੰ ਡਰ ਹੁੰਦਾ ਆਪਦੇ ਬੱਚਿਆਂ ਨੂੰ ਸੇਫ ਰੱਖਣ ਲਈ ਤਾਂ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਕੁੜੀਆਂ ਰਾਤ ਨੂੰ ਜਾਂ ਸ਼ਾਮ ਨੂੰ ਜ਼ਿਆਦਾ ਟਾਈਮ ਬਾਹਰ ਨਹੀਂ ਰਹਿ ਸਕਦੀਆਂ ਅਤੇ ਉਹਨਾਂ ਨੂੰ ਟਾਈਮ ਨਾਲ ਘਰ ਉਹਨਾਂ ਪੈਂਦਾ ਜੇਕਰ ਥੋੜ੍ਹਾ ਲੇਟ ਹੋ ਜਾਂਦੀਆਂ ਨੇ ਤਾਂ ਉਹਨਾਂ ਦੇ ਮਾਂ ਪਿਓ ਨੂੰ ਫਿਕਰ ਹੁੰਦੀ ਹੈ ਜਾਂ ਫਿਰ ਕੁੜੀਆਂ ਦੇ ਆਉਣ ਜਾਣ ਵਾਸਤੇ ਕੋਈ ਸੁਵਿਧਾ ਘੱਟ ਹੁੰਦੀ ਹੈ ਕਈ ਵਾਰ ਤਾਂ ਇਹ ਕੁੜੀਆਂ ਨੂੰ ਪ੍ਰੋਬਲਮ ਹੈ ਕਿ ਕਈ ਵਾਰ ਉਹਨਾਂ ਨੂੰ ਜੇ ਬਾਹਰ ਪੜ੍ਹਨਾ ਪੈਂਦਾ ਤਾਂ ਉੱਥੇ ਉਹਨਾਂ ਦਾ ਰਹਿਣ ਦਾ ਕਿਉਂਕਿ ਇਸ ਸਮੇਂ ਜੋ ਵੀ ਟਾਈਮ ਚੱਲ ਰਿਹਾ ਉਹ ਹਿਸਾਬ ਨਾਲ ਕੁੜੀਆਂ ਦੀ ਸੇਫਟੀ ਆ ਜਿਹੜੀ ਉਹ ਥੋੜ੍ਹੀ ਘੱਟ ਆ ਜੇਕਰ ਸਰਕਾਰ ਇਸ ਚੀਜ਼ 'ਤੇ ਕੋਈ ਐਕਸ਼ਨ ਲਵੇ ਤਾਂ ਮੈਨੂੰ ਲੱਗਦਾ ਕੁੜੀਆਂ ਹੋਰ ਵੀ ਬਹੁਤ ਤਰੱਕੀ ਕਰਨ ਸੋ ਮੈਂ ਤਾਂ ਇਹ ਚਾਹੁੰਦੀ ਹਾਂ ਕਿ ਕੁੜੀਆਂ ਦੇ ਵਾਸਤੇ ਸਰਕਾਰ ਨੂੰ ਕੋਈ ਵੱਡਾ ਐਕਸ਼ਨ ਲੈਣਾ ਚਾਹੀਦਾ ਕੋਈ ਨਾ ਕੋਈ ਕਾਨੂੰਨ ਐਵੇਂ ਦਾ ਹੋਣਾ ਚਾਹੀਦਾ ਕੁੜੀਆਂ ਦੀ ਸੇਫਟੀ ਲਈ ਹੋਵੇ ਕਿ ਕੁੜੀਆਂ ਵੀ ਬਾਹਰ ਜਾ ਕੇ ਆਪਣੇ ਖੇਤਰ ਤੋਂ ਬਾਹਰ ਜਾ ਕੇ ਵੀ ਜੇਕਰ ਪੜ੍ਹਾਈ ਕਰਨ ਅਤੇ ਉਹਨਾਂ ਨੇ ਇਸ ਤਰ੍ਹਾਂ ਦੀ ਕੋਈ ਫਿਕਰ ਨਾ ਹੋਵੇ ਮੇਰੇ ਹਿਸਾਬ ਨਾਲ ਤਾਂ ਇਹ ਸਭ ਤੋਂ ਵੱਡੀ ਫਿਕਰ ਹੈ ਜਿਹੜੀ ਕਿ ਕੁੜੀਆਂ ਨੂੰ ਵੀ ਹੈ ਅਤੇ ਉਹਨਾਂ ਦੇ ਮਾਂ ਪਿਓ ਨੂੰ ਵੀ ਆ ਅਤੇ ਇਸ ਕਰਕੇ ਕਈ ਵਾਰ ਕਈ ਕੁੜੀਆਂ ਦੀ ਪੜ੍ਹਾਈ ਵਿੱਚੇ ਰਹਿ ਜਾਂਦੀ ਹੈ ਕਿਉਂਕਿ ਪੇਂਡੂ ਇਲਾਕੇ ਤੋਂ ਸ਼ਹਿਰ ਵਿੱਚ ਜਾਣਾ ਜਾਂ ਕਿਸੇ ਵੱਡੇ ਸ਼ਹਿਰ ਵਿੱਚ ਜਾਣਾ ਉੱਥੇ ਰਹਿਣਾ ਇੱਕ ਸੌਖਾ ਕੰਮ ਨਹੀਂ ਹੁੰਦਾ ਬਾਕੀ ਕੁੜੀਆਂ ਦੀ ਮਿਹਨਤ ਬਹੁਤ ਕਰ ਰਹੀਆਂ ਨੇ ਅੱਗੇ ਵਧਣ ਵਾਸਤੇ ਅਤੇ ਬਹੁਤ ਕੁਝ ਚੇਂਜ ਵੀ ਹੋ ਰਿਹਾ ਇਸ ਗੱਲ ਦੀ ਖੁਸ਼ੀ ਵੀ ਹੈਗੀ ਆ